ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਸਾਡੇ ਕੋਲ ਲੇਡੀਜ਼ ਅਤੇ ਜੈਨਟਸ ਦੇ ਕਲੌਥ ਹੈ ਟ੍ਰੇਡੀਸ਼ਨ ਜੈਨਟਸ ਦੇ ਕੁੜਤਾ ਪਜਾਮਾ ਏ ਚਾਦਰਾ ਹੁੰਦਾ ਕੈਂਠਾ ਪੰਜਾਬੀ ਜੁੱਤੀ ਅਤੇ ਤੁਰਲੇ ਵਾਲੀ ਪੱਗ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਮਿਲ ਜੂਗੀ ਪੰਜ ਸੌ ਹਾਂਜੀ ਲੇਡੀਜ਼ ਲਈ ਸੂਟ ਹੈ ਸੱਗੀ ਫੁੱਲ ਹੈ ਕਾਂਟੇ ਹੈ ਝੁੰਮਰ ਹੈ ਗਲੇ ਵਾਲਾ ਹਾਰ ਹੈ ਕ ਕੰਗਣ ਵੀ ਹੈ ਝਾਂਜਰਾਂ ਵੀ ਹੈ ਅਤੇ ਜੁੱਤੀ ਵੀ ਹੈ ਆਪਣੀ ਵਾਈਫ਼ ਲਈ ਲੈ ਹਾ ਹਾਂਜੀ ਹਾਂਜੀ ਮਿਲਜੂ ਪਰਾਈਜ਼ ਜੁੱਤੀ ਤਾਂ ਹਜ਼ਾਰ ਤੋਂ ਸਟਾਰਟਿੰਗ ਹੈ ਹਾਂਜੀ ਜੈਨਟਸ ਦੀ ਜੁੱਤੀ 'ਚ ਓਹਦੇ ਪੰਦਰਾਂ ਸੌ ਤੋਂ ਸਟਾਰਟਿੰਗ ਹਾਂਜੀ ਹਾਂਜੀ ਦੋ ਸੌ ਤੋਂ ਸਟਾਰਟਿੰਗ ਹੈ ਕੈਂਠੇ

ਓਕੇ